ਮੈਨੂੰ ਖੋ ਖੋ ਗੇਮ ਬਹੁਤ ਹੀ ਮੁਸ਼ਕਲ ਲੱਗਦੀ ਹੈ ਮੈਨੂੰ ਇਹ ਪਹਿਲਾਂ ਖੇਡਣੀ ਨਹੀਂ ਸੀ ਆਉਂਦੀ ਜਿਸ ਕਾਰਨ ਮੈਨੂੰ ਇਹ ਬਹੁਤ ਮੁਸ਼ਕਲ ਲੱਗਦੀ ਸੀ ਮੈਨੂੰ ਇਸ ਦੇ ਰੂਲ ਵੀ ਨਹੀਂ ਸੀ ਪਤਾ ਮੈਨੂੰ ਇਹ ਜਮਾਂ ਵੀ ਨਹੀਂ ਸੀ ਖੇਡਣੀ ਆਉਂਦੀ ਇਸ ਬਾਰੇ ਕੁਝ ਨਹੀਂ ਸੀ ਪਤਾ ਮੈਨੂੰ ਇਹ ਹੁਣ ਕੋਲਿਜ ਵਿੱਚ ਜਾ ਕੇ ਖੇਡਣੀ ਆਈ ਹੈ ਮੈਨੂੰ ਇਹ ਮੈਨੂੰ ਇਸ ਵਿੱਚ ਚੁਸਤੀ ਨਾਲ਼ ਖੇਡਣਾ ਨਹੀਂ ਸੀ ਆਉਂਦਾ ਹੁਣ ਮੈਂ ਰੋਜ਼ ਉੱਥੇ ਅਭਿਆਸ ਕਰਦੀ ਹਾਂ ਅਤੇ ਕੱਲ੍ਹ ਸਾਡਾ ਖੋ ਖੋ ਦਾ ਹੀ ਟੂਰਨਾਮੈਂਟ ਹੈ ਉਮੀਦ ਹੈ ਕੀ ਸਾਡੀ ਟੀਮ ਜਿੱਤ ਜਾਵੇ ਖੋ ਖੋ ਇੱਕ ਬਹੁਤ ਵਧੀਆ ਗੇਮ ਹੈ ਪਰ ਪਹਿਲਾਂ ਮੈਨੂੰ ਇਹ ਬਹੁਤ ਹੀ ਜ਼ਿਆਦਾ ਮੁਸ਼ਕਲ ਗੇਮ ਲੱਗਦੀ ਸੀ ਪਰ ਹੁਣ ਮੈਨੂੰ ਇਹ ਬਹੁਤ ਵਧੀਆ ਲੱਗਦੀ ਹੈ ਕਿਉਂਕਿ ਅਭਿਆਸ ਕਰਨ ਤੋਂ ਬਾਅਦ ਮੈਨੂੰ ਇਹ ਅਹਿਸਾਸ ਹੋਇਆ ਹੈ ਕੀ ਅਭਿਆਸ ਕਰਨ ਨਾਲ਼ ਕੋਈ ਵੀ ਮੁਸ਼ਕਲ ਕੰਮ ਅਸਾਨ ਹੋ ਸਕਦਾ ਹੈ